ਮੈਨੂੰ ਬਾਈਕ ਚਲਾਉਣੀ ਬੜੇ ਹੀ ਪਸੰਦ ਹੈ ਸਾਡੇ ਇੱਕ ਗਰੁੱਪ ਬਣਿਆ ਹੋਇਆ ਹੈ ਜਿਸ ਦੇ ਵਿੱਚ ਆਪਾਂ ਯਾਰਾਂ ਦੋਸਤਾਂ ਨਾਲ ਮਹੀਨੇ ਦੇ ਵਿੱਚ ਇੱਕ ਲੋਂਗ ਡਰਾਈਵ 'ਤੇ ਜਾਣਾ ਪਸੰਦ ਕਰਦੇ ਹਾਂ ਅਸੀਂ ਤਾਂ ਵੱਖ ਵੱਖ ਇਲਾਕਿਆਂ ਵਿੱਚ ਜਾਂਦੇ ਹਾਂ ਅਤੇ ਘੁੰਮਦੇ ਫਿਰਦੇ ਅਤੇ ਕਾਫੀ ਯਾਰਾਂ ਦੋਸਤਾਂ ਨੂੰ ਮਿਲਦੇ ਹੋਏ ਜਾਂਦੇ ਹਾਂ ਲੋਕਾਂ ਦੇ ਜਿਸ ਤਰ੍ਹਾਂ ਅਸੀਂ ਕਈ ਵਾਰੀ ਹਿਮਾਚਲ ਵੱਲ ਬਈ ਚਲੇ ਜਾਂਦੇ ਹਾਂ ਜਿਨ੍ਹਾਂ ਵਿੱਚ ਅਸੀਂ ਉਹਨਾਂ ਦੀ ਦੇ ਨਾਲ ਗੱਲਬਾਤ ਸਾਂਝ ਕਰਦੇ ਹਾਂ ਅਤੇ ਉਹਨਾਂ ਦੇ ਵਿ ਦੇ ਤਿਆਰ ਅਤੇ ਉਹਨਾਂ ਦੀ ਬੋਲੀ ਅਤੇ ਉਹਨਾਂ ਦੇ ਸਾਰੇ ਸੱਭਿਆਚਾਰਾਂ ਦੇ ਬਾਰੇ ਜਾਣਨ ਦੀ ਕੋਸ਼ਿਸ਼ ਕਰਦੇ ਹਾਂ ਕਿਉਂਕਿ ਹਿਮਾਚਲ ਦੇ ਬੰਦੇਰੇ ਲੋਕ ਕਾਫੀ ਹੀ ਭੋਲੇ ਭਾਲੇ ਅਤੇ ਮਾਸੂਮ ਬੰਦੇ ਹੁੰਦੇ ਹਨ ਜੋ ਕਿ ਉਨਾਂ ਦਾ ਕਲਚਰ ਕਾਫੀ ਅੱਛਾ ਅਤੇ ਸਾਫ਼ ਸੁਥਰਾ ਹੁੰਦਾ ਹੈ ਜੋ ਕਿ ਉਹ ਸਾਡੇ ਨਾਲ ਗੱਲਾਂ ਬਾਤਾਂ ਕਰਕੇ ਸਾਂਝ ਪਾ ਕੇ ਗੱਲਾਂ ਕਰਦੇ ਹਨ ਅਤੇ ਆਪਣੇ ਆਪਣੇ ਰੀਤੀ ਰਿਵਾਜ਼ਾਂ ਬਾਰੇ ਪੁੱਛਦੇ ਹਨ ਅਤੇ ਸਾਡੇ ਰੀਤੀ ਰਿਵਾਜ਼ਾਂ ਬਾਰੇ ਵੀ ਜਾਣਨ ਦੀ ਕੋਸ਼ਿਸ਼ ਕਰਦੇ ਹਨ ਅਤੇ ਉਹਨਾਂ ਦੀ ਇਹ ਉਹਨਾਂ ਦਾ ਕਾਫੀ ਵਿਆਹ ਸ਼ਾਦੀ ਦਾ ਪ੍ਰੋਗਰਾਮ ਬਾਰੇ ਗੱਲਾਂ ਕਰਦੇ ਹਨ ਜੋ ਕਿ ਬੜਾ ਹੀ ਸਿੰਪਲ ਅਤੇ ਵਧੀਆ ਤਰੀਕੇ ਨਾਲ ਹੁੰਦਾ ਹੈ ਜਿਸ ਤਰ੍ਹਾਂ ਉਹ ਵਿਆਹ ਦੇ ਵਿੱਚ ਆਪਣਾ ਨੀਚੇ ਬੈਠ ਕੇ ਲੰਗਰ ਤਰ੍ਹਾਂ ਹੀ ਲੋਕਾਂ ਦੀ ਸੇਵਾ ਕਰਦੇ ਹਨ ਅਤੇ ਇੱਦਾਂ ਦਾ ਕਲਚਰ ਸਾਨੂੰ ਕਾਫੀ ਸਿੰਪਲ ਅਤੇ ਕਾਫੀ ਪਸੰਦ ਹੈ ਅਤੇ ਇਸ ਇਸ ਤਰ੍ਹਾਂ ਅਸੀਂ ਬਾਈਕ ਵਿੱਚ ਕਾਫੀ ਜਣਿਆਂ ਨਾਲ ਮਿਲ ਗੁਫਤਗੂ ਗੱਲਾਂ ਬਾਤਾਂ ਕਰਦੇ ਹਾਂ ਅਤੇ ਅਸੀਂ ਵਾਪਸ ਹੀ ਫਿਰ ਇਸ ਤਰ੍ਹਾਂ ਗਰੁੱਪ ਦੇ ਗਰੁੱਪ ਮੁ ਬਾਈਕਾਂ 'ਤੇ ਚਲਾਉਣਾ ਜਾਂਦੇ ਹਾਂ ਬਾਈਕ ਚਲਾਉਣੀ ਮੇਰਾ ਸ਼ੌਂਕ ਅਤੇ ਘੁੰਮਣਾ ਫਿਰਨਾ ਮੇਰਾ ਸ਼ੌਂਕ ਹੈ ਅਤੇ ਇੱਕ ਅਲੱਗ ਅਲੱਗ ਬੰਦਿਆਂ ਨੂੰ ਮਿਲਣ ਦਾ ਮੇਰਾ ਸ਼ੌਂਕ ਹੈ